ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਅੱਛਾ ਠੀਕ ਹੈ ਤੁਸੀਂ ਜਿਹੜੇ ਨਵੇਂ ਸ਼ਿਫਟ ਹੋਏ ਹੋ ਹਾਂਜੀ ਹਾਂਜੀ ਮੈਂ ਤੁਹਾਨੂੰ ਮਿਲਣਾ ਤਾਂ ਸੀਗਾ ਪਰ ਮੈਂ ਉਸ ਦਿਨ ਕੋਈ ਕੰਮ ਸੀਗਾ ਤਾਂ ਮੈਂ ਆ ਨਹੀਂ ਪਾਈ ਸੀਗੀ ਹਾਂਜੀ ਕਿਵੇਂ ਅੱਛਾ ਹਾਂਜੀ ਅੱਛਾ ਹਾਂਜੀ ਹਾਂਜੀ ਤਾਜ਼ਾ ਸਬਜ਼ੀਆਂ ਇੱਥੇ ਮਿਲ ਹੀ ਜਾਣ ਗੀਆਂ ਤੁਹਾਨੂੰ ਵੈਸੇ ਤਾਂ ਅਸੀਂ ਤਾਂ ਵੈਸੇ ਆਪਣਾ ਗਾਰਡਨ ਵੀ ਬਣਾਇਆ ਹੋਇਆ ਘਰ ਉੱਥੇ ਅਸੀਂ ਛੋਟੀ ਮੋਟੀ ਸਬਜ਼ੀ ਵਗੈਰਾ ਉਗਾ ਲੈਂਦੇ ਹਾਂ ਜਿਵੇਂ ਪਿਆਜ ਹੋ ਗਿਆ ਐਵੇਂ ਦੀ ਸਬਜ਼ੀਆਂ ਉਗਾ ਲੈਂਦੇ ਹਾਂ ਵੈਸੇ ਤਾਜ਼ਾ ਸਬਜ਼ੀਆਂ ਤੁਹਾਨੂੰ ਇੱਥੇ ਮੰਡੀ ਹੈਗੀ ਆ ਉਥੋਂ ਮਿਲ ਜੂਗੀ ਐਵੇਂ ਮਤਲਬ ਰੇੜੀ ਵਗੈਰਾ ਤੋਂ ਨਾ ਲਈਓ ਤੁਸੀਂ ਸ ਅ ਤਾਜ਼ਾ ਸਬਜ਼ੀਆਂ ਉੱਥੇ ਤਾਜ਼ਾ ਤਾਂ ਹੁੰਦੀਆਂ ਹੀ ਨਹੀਂ ਬਸ ਉਹੀ ਹੁੰਦੀਆਂ ਤਾਂ ਕਰਕੇ ਤੁਸੀਂ ਮੰਡੀ 'ਚੋਂ ਹੀ ਲਈਓ ਸਬਜ਼ੀਆਂ ਅਸੀਂ ਤਾਂ ਉੱਥੋਂ ਹੀ ਲੈ ਕੇ ਆਉਂਦੇ ਹਾਂ ਸਬਜ਼ੀ ਮੰਡੀ ਤੋਂ ਹੀ ਹਾਂਜੀ ਅਸੀਂ ਵੀ ਨਿਊਟਰੀਸ਼ਨ ਦਾ ਬਹੁਤ ਧਿਆਨ ਰੱਖਦੇ ਹਾਂ ਤਾਂ ਹੀ ਅਸੀਂ ਖੁਦ ਦਾ ਗਾਰਡਨ ਵੀ ਬਣਾਇਆ ਹੋਇਆ ਅਤੇ ਤਾਂ ਹੀ ਅਸੀਂ ਤਾਜ਼ਾ ਜਿਹੜੀਆਂ ਸਬਜ਼ੀਆਂ ਉਥੋਂ ਹੀ ਲੈ ਕੇ ਆਉਂਦੇ ਹਾਂ ਅਸੀਂ ਮੰਡੀ 'ਚ ਹੀ ਤਾਂ ਕਿ ਜਿਹੜਾ ਆਪਣਾ ਹੈਲਥ ਆ ਉਹ ਜਿਹੜੀ ਫਿੱਟ ਰਹੇ ਆਪਣੀ ਹਮ ਇਹ ਮੰਡੀ ਕੋਈ ਨਹੀਂ ਆਪਾਂ ਨਾ ਸਵੇਰੇ ਚੱਲਾਂਗੇ ਮੰਡੀ ਕੋ ਜਦੋਂ ਮੈਂ ਜਾਊਂਗੀ ਨਾ ਸਬਜ਼ੀ ਲੈਣ ਸਵੇਰ ਦੇ ਟਾਈਮ 'ਚ ਉੱਥੇ ਸ ਤਾਜ਼ਾ ਸਬਜ਼ੀਆਂ ਹੁੰਦੀਆਂ ਅਤੇ ਸਬਜ਼ੀਆਂ ਦੀ ਵਰਾਈਟੀਆਂ ਵੀ ਵੱਧ ਹੁੰਦੀਆਂ ਤਾਂ ਸਵੇਰ ਦੇ ਟਾਈਮ ਜਾਣਾ ਜ਼ਿਆਦਾ ਬੈਟਰ ਰਹੇਗਾ ਤੁਸੀਂ ਮੈਨੂੰ ਦੱਸ ਦਿਓ ਵੀ ਤੁਸੀਂ ਕਿਹੜੇ ਟਾਈਮ ਸਵੇਰੇ ਫਰੀ ਹੁੰਦੇ ਹੋ ਉਸ ਟਾਈਮ ਆਪਾਂ ਚੱਲਾਂਗੇ ਹਾਂਜੀ ਵੈਸੇ ਤੁਸੀਂ ਕਿਸ ਹਰੀਆਂ ਸਬਜ਼ੀਆਂ ਜ਼ਿਆਦਾ ਪਸੰਦ ਕਰਦੇ ਹੋ ਕਿ ਕਿਹੜੀਆਂ ਹਾਂਜੀ ਹਰੀਆਂ ਸਬਜ਼ੀਆਂ ਆਪਣੇ ਸਿਹਤ ਲਈ ਵੀ ਉਹ ਹੁੰਦੀਆਂ ਨਾ ਵਧੀਆ ਹੁੰਦੀਆਂ ਅਸੀਂ ਵੀ ਜ਼ਿਆਦਾਤਰ ਹਰੀਆਂ ਸਬਜ਼ੀਆਂ ਹੀ ਲੈ ਕੇ ਆਉਂਦੇ ਹਾਂ ਉੱਥੇ ਤਾਂ ਮੰਡੀ 'ਚ ਹਰੀਆਂ ਸਬਜ਼ੀਆਂ ਵੀ ਕਾਫ਼ੀ ਆਉਣ ਲੱਗ ਗਈਆਂ ਹੁਣ ਤਾਂ ਜਿਵੇਂ ਸਰਦੀਆਂ ਦਾ ਮੌਸਮ ਹੈ ਤਾਂ ਸਬਜ਼ੀ ਮੰਡੀ 'ਚ ਸਾਗ ਵਗੈਰਾ ਬਹੁਤ ਆਉਣ ਲੱਗ ਗਿਆ ਪਾਲਕ ਹਮ ਬਾਕੀ ਆਪਾਂ ਸ ਹਮ ਹਾਂਜੀ ਪਾਲਕ 'ਚ ਤਾਂ ਬਹੁਤ ਆਇਰਨ ਹੁੰਦਾ ਤਾਂ ਕਰਕੇ ਤਾਜ਼ਾ ਤਾਂ ਫਿਰ ਤੁਹਾਨੂੰ ਮੰਡੀ 'ਚ ਹੀ ਮਿਲਣਗੀਆਂ ਐਵੇਂ ਕਿਸੇ ਰੇੜੀ ਤੋਂ ਨਾ ਲਈਓ ਕਿਉਂਕਿ ਉੱਥੇ ਤਾਜ਼ਾ ਨਹੀਂ ਹੁੰਦੀਆਂ ਸਬਜ਼ੀਆਂ ਹਾਂਜੀ ਫਿਰ ਆਪਾਂ ਸਵੇਰੇ ਚੱਲਾਂਗੇ ਹਾਂਜੀ ਠੀਕ ਸਤਿ ਸ਼੍ਰੀ ਅਕਾਲ